ਬਾਈਕ ਚਲਾ ਕੇ ਬਹੁਤ ਹੀ ਅੱਛਾ ਵਰਨਰ ਮੈਂ ਪੇਸ਼ ਕਰਨ ਜਾ ਰਿਹਾ ਹਾਂ ਕਿਉਂਕਿ ਮੇਰੀ ਆਪਣੀ ਖੁਦ ਦੀ ਇੱਕ ਹੋਬੀ ਬਾਈਕ ਚਲਾਉਣਾ ਹੈ ਬਾਈਕ ਚਲਾਉਣਾ ਮੈਨੂੰ ਬੜਾ ਅੱਛਾ ਲੱਗਦਾ ਇਹਦੇ ਨਾਲ ਮੈਨੂੰ ਊਰਜਾ ਆਉਂਦੀ ਹੈ ਜਦੋਂ ਵੀ ਮੈਂ ਆਫ ਰਾਈਡਿੰਗ 'ਤੇ ਜਾਂਦਾ ਹਾਂ ਮੇਰੀ ਪਿਛਲੀ ਔਫ ਰਾਈਟਿੰਗ ਦੀ ਜਿਸ ਦਾ ਮੈਂ ਵਰਨਰ ਕਰਨ ਜਾ ਰਿਹਾ ਹਾਂ ਮੈਂ ਪਿਛਲੀ ਆਫ ਰਾਈਡਿੰਗ ਲੇਹ ਲਦਾਖ ਦੇ ਵਿੱਚ ਗਿਆ ਸੀ ਜਿਹੜਾ ਵੀ ਰਸਤੇ ਦੇ ਵਿੱਚ ਮੈਂ ਤੁਹਾਨੂੰ ਵਰਨਣ ਕਰਨ ਜਾ ਰਿਹਾ ਉਸ ਦਾ ਮੇਨ ਚੀਜ਼ ਇਹ ਸੀ ਕਿ ਮੈਨੂੰ ਇਸ ਨਾਲ ਬੜੀ ਹੀ ਊਰਜਾ ਮਿਲਦੀ ਹੈ ਜਦੋਂ ਮੈਂ ਬਾਈਕ 'ਤੇ ਰਸਤੇ ਵਿੱਚ ਜਾ ਰਿਹਾ ਸੀ ਉਥੋਂ ਦਾ ਸਾਰਾ ਵਰਨਰ ਤੁਹਾਨੂੰ ਪੇਸ਼ ਕਰਨ ਜਾ ਰਿਹਾ ਕਿ ਬਾਈਕਿੰਗ ਚਲਾਨ ਦੇ ਨਾਲ ਮੈਂ ਬੜਾ ਹੀ ਅੱਛਾ ਉਤਸਾਹ ਫੀਲ ਕਰਦਾ ਹਾਂ ਬਾਈਕਿੰਗ ਚਲਾਨ ਦੇ ਨਾਲ ਸਭ ਤੋਂ ਪਹਿਲਾਂ ਸਾਨੂੰ ਕੁਝ ਸੇਫਟੀ ਵੀ ਵਰਤਣੀ ਪੈਂਦੀ ਹੈ ਸੇਫਟੀ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਇੱਕ ਅੱਛੇ ਨਾਗਰਿਕ ਦੀ ਤੌਰ 'ਤੇ ਬੜੇ ਹੀ ਆਰਾਮ ਦੇ ਨਾਲ ਬਾਈਕ ਚਲਾਉਣਾ ਪੈਂਦਾ ਹੈ ਅਤੇ ਮੇਰਾ ਇਹੀ ਇੱਕ ਮੇਨ ਮੁੱਦਾ ਰਿਹਾ ਹੈ ਕਿ ਕੋਈ ਵੀ ਬੰਦਾ ਜਿਹੜਾ ਬਾਈਕ 'ਤੇ ਕਿੰਨੀ ਵੀ ਦੂਰ ਜਾ ਰਿਹਾ ਜਾਂ ਕੋਈ ਆਪਣੇ ਸ਼ੌਂਕ ਦੇ ਨਾਲ ਇੱਕ ਲੰਬਾ ਸਫਰ ਕਰ ਰਿਹਾ ਹੈ ਅਤੇ ਉਸ ਨੂੰ ਹੀ ਬੜੇ ਹੀ ਚੰਗੇ ਢੰਗ ਦੇ ਨਾਲ ਬਾਈਕ ਚਲਾਉਣੀ ਚਾਹੀਦੀ ਹੈ ਬਾਈਕ ਚਲਾਨ ਦੇ ਨਾਲ ਦੇ ਨਾਲ ਅਸੀਂ ਆਪਣੇ ਆਪ ਨੂੰ ਵੀ ਸੇਫ ਕਰਨਾ ਹੁੰਦਾ ਹੈ ਜਦੋਂ ਤੁਸੀਂ ਇੱਕ ਲੰਬੀ ਡਰਾਈਵ 'ਤੇ ਜਾ ਰਹੇ ਹੋ ਤਾਂ ਉੱਥੇ ਕੁਝ ਗੱਲਾਂ ਆਪਣੇ ਮਨ ਦੇ ਅੰਦਰ ਇਹ ਕਰਨੀਆਂ ਚਾਹੀਦੀਆਂ ਸੀ ਕਿ ਸਾਨੂੰ ਬਾਈਕ ਬੜੇ ਹੀ ਮਾਧਿਅਮ ਗਤੀ ਦੇ ਨਾਲ ਚਲਾਉਣੀ ਚਾਹੀਦੀ ਹੈ ਕਿਉਂਕਿ ਮੱਧਮ ਗਤੀ ਦੇ ਨਾਲ ਚਲਾਨ ਦੇ ਨਾਲ ਸਾਡਾ ਸਰੀਰ ਵੀ ਅੱਛਾ ਰਹਿੰਦਾ ਹੈ ਅਤੇ ਅਸੀਂ ਆਪਣੇ ਆਪ ਨੂੰ ਇੱਕ ਅੱਛੀ ਊਰਜਾ ਦੇ ਨਾਲ ਇੱਕ ਇੱਕ ਕਦਮ ਉਠਾਉਂਦੇ ਹਾਂ ਕਿ ਅਸੀਂ ਬਾਈਕ ਚਲਾ ਰਹੇ ਹਾਂ ਕਿ ਕਿਸੇ ਨੂੰ ਵੀ ਦੂਸਰੇ ਨੂੰ ਵੀ ਨੁਕਸਾਨ ਨਾ ਹੋਵੇ ਅਤੇ ਸਾਨੂੰ ਵੀ ਨੁਕਸਾਨ ਨਾ ਹੋਵੇ